ਮੈਨੂੰ ਪੰਜਾਬੀ ਗੀਤ ਬਹੁਤ ਜ਼ਿਆਦਾ ਪਸੰਦ ਹਨ ਬਹੁਤ ਸਾਰੇ ਪੰਜਾਬੀ ਗਾਇਕ ਹਨ ਜਿਵੇਂ ਨਿਮਰਤ ਖਹਿਰਾ ਤਰਸੇਮ ਜੱਸੜ ਜੱਸਾ ਢਿੱਲੋਂ ਹੋਰ ਵੀ ਬਹੁਤ ਸਾਰੇ ਅਮਰਿੰਦਰ ਗਿੱਲ ਬਹੁਤ ਸਾਰੇ ਗਾਇਕ ਹਨ ਪਰ ਮੇਰਾ ਜਿਹੜਾ ਸਭ ਤੋਂ ਪਸੰਦੀਦਾ ਗਾਇਕ ਹੈ ਉਹ ਹੈ ਸ਼ੁਭ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਉਹ ਕਿ ਉਹ ਗਾਇਕ ਫ਼ੋਰਨਰ ਗਾਇਕ ਹੈ ਉਹ ਫੋਰਨ ਵਿੱਚ ਗਾਉਂਦਾ ਹੈ ਵੈਸੇ ਤਾਂ ਉਹ ਪੰਜਾਬ ਵਿੱਚ ਹੀ ਪੈਦਾ ਹੋਇਆ ਸੀ ਪਰ ਹੁਣ ਉਹ ਫ਼ੋਰਨ ਚਲਾ ਗਿਆ ਉਹਦੇ ਗਾਣੇ ਮੈਨੂੰ ਬਹੁਤ ਪਸੰਦ ਹਨ ਉਹ ਬਹੁਤ ਵਧੀਆ ਲਿਖਦਾ ਬਹੁਤ ਵਧੀਆ ਗਾਉਂਦਾ ਉਹਦੀ ਆਵਾਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਅਤੇ ਮੈਂ ਮਤਲਬ ਗੱਡੀ 'ਚ ਜਦੋਂ ਵੀ ਕੋਈ ਸਫਰ ਕਰ ਰਹੀ ਹੁੰਦੀ ਹਾਂ ਸਿਰਫ ਉਹਦੇ ਹੀ ਗਾਣੇ ਸੁਣਨਾ ਪਰੈਫਰ ਕਰਦੀ ਹਾਂ ਜ਼ਿਆਦਾ ਪਸੰਦ ਕਰਦੀ ਹਾਂ ਜਾਂ ਫਿਰ ਕਮਰੇ 'ਚ ਬੈਠੀ ਹੋਵਾਂ ਟੀ ਵੀ 'ਤੇ ਵੀ ਸਿਰਫ ਉਹਦੇ ਹੀ ਗਾਣੇ ਸੁਣਦੀ ਹਾਂ ਅਤੇ ਉਹਦੇ ਸਭ ਵੈਸੇ ਤਾਂ ਬਹੁਤ ਸਾਰੇ ਗਾਣੇ ਹਨ ਜਿਵੇਂ ਕਿ ਬੈਲਰ ਐਲੀਵੇਟਿਡ ਓਡੈਂਥਮ ਪਰ ਜਿਹੜਾ ਉਹਦਾ ਸਭ ਮੈਨੂੰ ਜਿਹੜਾ ਸਭ ਤੋਂ ਉਹਦਾ ਫੇਵਰੇਟ ਗਾਣਾ ਲੱਗਦਾ ਉਹ ਹੈ ਕਿੰਗਸ਼ੇਟ ਜੇ ਜਿਹੜਾ ਕਿ ਉਹਨੇ ਕੰਗਣਾ ਰਣੌਤ ਰੋਨਟ ਦੀ ਬੇਇੱਜ਼ਤੀ ਉੱਤੇ ਬਣਾਇਆ ਸੀ ਮੈਨੂੰ ਬਹੁਤ ਵਧੀਆ ਲੱਗਦਾ ਉਹ ਗਾਣਾ ਵੈਸੇ ਤਾਂ ਮੈਨੂੰ ਹੋਰ ਵੀ ਜਿਵੇਂ ਗਾਣੇ ਪਸੰਦ ਹਨ ਜਿਵੇਂ ਕਿ ਕੋਰੀਅਨ ਸੋਂਗਸ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸਭ ਤੋਂ ਜ਼ਿਆਦਾ ਬਲੈਕਪਿੰਕ ਆਰਟਿਸਟ ਉਹਨਾਂ ਦੇ ਮੈਨੂੰ ਸਾਰੇ ਗਾਣੇ ਕਾਫੀ ਵਧੀਆ ਲੱਗਦੇ ਹਨ ਅਤੇ ਜਿਵੇਂ ਕਿ ਆਈਸ ਕਰੀਮ ਹਾਈ ਹਾਈਓ ਲਾਈਕ ਦੈਟ ਇਹੋ ਜਿਹੇ ਜਿਵੇਂ ਸਾਰੇ ਮੈਨੂੰ ਵਧੀਆ ਲੱਗਦੇ ਹਨ ਗਾਣੇ